ਹੈਲੋ ਸਤਿ ਸ਼੍ਰੀ ਅਕਾਲ ਸਰ ਜੀ ਸਰ ਜੀ ਮੈਂ ਸਮਾਕਸ਼ੀ ਦੀ ਮੰਮੀ ਬੋਲਣ ਡੀ ਹਾਂ ਹਾਂਜੀ ਹਾਂਜੀ ਮੈਂ ਮੇਰੇ ਨਾ ਭਰਾ ਦਾ ਵਿਆਹ ਸੀਗਾ ਤਾਂ ਇਸ ਕਰਕੇ ਉਹਨੂੰ ਛੁੱਟੀ ਚਾਹੀਦੀ ਸੀ ਦਸ ਕੁ ਦਿਨ ਦੀ ਛੁੱਟੀਆਂ ਚਾਹੀਦੀਆਂ ਸੀ ਨਾਲੇ ਤੁਹਾਨੂੰ ਪਤਾ ਹੀ ਨਾ ਵਿਆਹ 'ਚ ਕਿੰਨਾ ਕੰਮ ਹੁੰਦਾ ਫਿਰ ਸਾਰਾ ਮੈਂ ਇੱਕ ਇਕੱਲੀ ਇਕੱਲੀ ਕੁੜੀ ਹਾਂ ਹੈ ਨਾ ਫਿਰ ਮੇਰੇ ਭਰਾ ਦਾ ਵਿਆਹ ਮੇਰਾ ਹੋਣਾ ਤਾਂ ਉੱਥੇ ਜ਼ਰੂਰੀ ਆ ਇਸ ਕਰਕੇ ਹਾਂਜੀ ਹਾਂਜੀ ਤੁਸੀਂ ਫਿਕਰ ਫੁਕਰ ਨਾ ਕਰੋ ਕੰਮ ਕੁਮ ਸਾਰਾ ਮੈਂ ਕਰਾ ਦਾਂਗੀ ਉਹ ਦਸ ਦਿਨ ਬਾਅਦ ਆ ਜਾਵੇਗੀ ਵੈਸੇ ਹਾਂਜੀ ਤੁਸੀਂ ਬਸ ਕਲਾਸ 'ਚ ਜਿਹੜਾ ਕੰਮ ਕੁਮ ਹੁੰਦਾ ਉਹ ਮੈਨੂੰ ਭੇਜ ਦਿਆ ਕਰੋ ਫੋਟੋਆਂ ਫੁਟੋਆਂ ਜਿਹੜਾ ਕੰਮ ਹੁੰਦਾ ਚਲੋ ਵਿਆਹ ਤੋਂ ਬਾਅਦ ਮੈਂ ਆਪਣੀ ਕੁੜੀ ਨੂੰ ਕਰਾ ਦਾਂਗੀ ਤੁਹਾਨੂੰ ਪਤਾ ਹੀ ਆ ਉਹ ਕਿੰਨੀ ਸ਼ੈਤਾਨ ਆ ਹਾਂਜੀ ਉਹਦਾ ਰੋਲ ਨੰਬਰ ਹੈ ਤਿੰਨ ਓਹਦਾ ਰੋਲ ਨੰਬਰ ਹੈ ਹਾਂਜੀ ਹਾਂਜੀ ਇੱਕ ਤਾਂ ਤੁਹਾਨੂੰ ਕਲਾਸ ਪਤਾ ਨਾ ਥਰਡ ਬੀ ਦੀ ਹੈ ਹਾਂਜੀ ਚਲੋ ਠੀਕ ਹੈ ਧੰਨਵਾਦ ਸਰ ਜੀ ਓਕੇ ਬਾਏ